ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਸਿਲਾਈ ਦਾ ਬਹੁਤ ਸ਼ੌਕ ਹੈ ਮੈਨੂੰ ਮੈਂ ਸਿਲਾਈ ਆਪਣੇ ਘਰ ਤੋਂ ਘਰ ਵੀ ਮੇਰੀ ਸਿਲਾਈ ਕਰਦੇ ਸੀਗੇ ਮੰਮੀ ਉਹਨਾਂ ਤੋਂ ਵੀ ਸਿੱਖੀ ਫਿਰ ਮੈਂ ਸਿਲਾਈ ਯੂਟੀਊਬ ਤੋਂ ਵੀ ਸਿੱਖੀ ਸੀਗੀ ਇਸ ਦੇ ਨਾਲ ਮੈਨੂੰ ਹੋਰ ਜ਼ਿਆਦਾ ਸ਼ੌਕ ਹੋ ਗਿਆ ਸਿਲਾਈ ਕਰਨ ਦਾ ਫਿਰ ਮੈਂ ਆਪਣੇ ਘਰ ਵਿੱਚ ਬੁਟੀਕ ਦਾ ਕੰਮ ਕੀਤਾ ਸਿਲਾਈ ਦਾ ਉਸਦੇ ਵਿੱਚ ਫਿਰ ਤਰ੍ਹਾਂ ਤਰ੍ਹਾਂ ਦੇ ਸੂਟ ਸੀਣ ਵਾਸਤੇ ਜਿਸ ਤਰ੍ਹਾਂ ਕਿ ਸਲਵਾਰ ਸੂਟ ਆ ਗਿਆ ਫਿਰ ਕੱਟ ਵਰਕ ਬਾਅਦ 'ਚੋਂ ਹੁਣ ਕੱਟ ਵਰਕ ਵਾਲੇ ਪੌਂਚੇ ਆ ਗਏ ਫ਼ਿਰ ਪਲਾਜੂ ਸੂਟ ਆ ਗਿਆ ਉਹ ਵੀ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਵਾ ਪਜਾਮੀ ਸੂਟ ਆ ਗਿਆ ਨਾਇਰਾ ਕੱਟ ਵਾਲੀ ਕੁੜਤੀ ਆ ਗਈ ਇਸ ਤਰ੍ਹਾਂ ਅਫਗਾਨੀ ਸਲਵਾਰ ਆ ਗਈ ਫਿਰ ਇਸ ਤਰ੍ਹਾਂ ਲੈਸਾਂ ਦਾ ਤਾਂ ਟਰੈਂਡ ਚੱਲ ਪਿਆ ਫਿਰ ਅਸੀਂ ਲੈਸਾਂ ਲਗਾ ਲਗਾ ਕੇ ਬਹੁਤ ਸਾਰੇ ਸੂਟ ਸੀਤੇ ਸਾੜੀ ਵਗੈਰਾ ਵੀ ਸਟਿੱਚ ਕੀਤੀ ਹੈ ਔਰ ਬਹੁਤ ਵਧੀਆ ਲੱਗਦਾ ਸਾਰੇ ਜਦੋਂ ਸੂਟ ਸਵਾਂਦੇ ਆ ਸਾਰੇ ਖੁਸ਼ ਹੁੰਦੇ ਸੂਟ ਦੀ ਫਿਟਿੰਗ ਵਗੈਰਾ ਵੀ ਕੇ ਵੇਖ ਕੇ ਔਰ ਇਸ ਤਰ੍ਹਾਂ ਸਾਡਾ ਕੰਮ ਹੋਰ ਜ਼ਿਆਦਾ ਅੱਗੇ ਵੱਧਦਾ ਗਿਆ ਔਰ ਮਨ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਇਸ ਤਰ੍ਹਾਂ ਜਦੋਂ ਕੰਮ ਅੱਗੇ ਵੱਧਦਾ ਜਾਵੇ ਓਕੇ